ਜੀ ਹਾਂ ਟੈਕਨੋਲੋਜੀ ਦੀ ਵਰਤੋਂ ਨੇ ਸੰਸਾਰ ਵਿੱਚ ਸਾਡੇ ਆਲੇ ਦੁਆਲੇ ਗੱਲਬਾਤ ਕਰਨ ਦੇ ਤਰੀਕੇ ਬਿਲਕੁਲ ਹੀ ਬਦਲ ਦਿੱਤੇ ਹਨ ਜੇ ਗੱਲ ਕਰੀਏ ਅੱਜ ਤੋਂ ਵੀਹ ਸਾਲ ਪਹਿਲਾਂ ਦੀ ਤਾਂ ਉਸ ਸਮੇਂ ਲੈਂਡਲਾਈਨ ਫੋਨ ਚਲਦੇ ਹੁੰਦੇ ਸਨ ਅਤੇ ਲੈਂਡਲਾਈਨ ਫੋਨ ਵੀ ਕਿਸੇ ਕਿਸੇ ਘਰ ਹੁੰਦੇ ਸਨ ਜਿਸ ਕਰਕੇ ਲੋਕ ਇੱਕ ਦੂਸਰੇ ਦੇ ਘਰ ਵਿੱਚ ਜਾ ਕੇ ਲੈਂਡਲਾਈਨ 'ਤੇ ਗੱਲ ਕਰਦੇ ਸਨ ਟੈਕਨੋਲਜੀ ਦੇ ਆਉਣ ਤੋਂ ਬਾਅਦ ਲੈਂਡਲਾਈਨ ਫੋਨ ਦੀ ਵਰਤੋਂ ਬਿਲਕੁਲ ਹੀ ਬੰਦ ਹੋ ਗਈ ਟੈਕਨੋਲੋਜੀ ਐਸੀ ਆਈ ਕਿ ਸਮਾਰਟਫੋਨ ਜਿਹੜੇ ਸਮਾਰਟਫੋਨ ਨੇ ਲੈਂਡਲਾਈਨ ਫੋਨਾਂ ਦੀ ਵਰਤੋਂ ਬਿਲਕੁਲ ਹੀ ਬੰਦ ਕਰ ਦਿੱਤੀ ਹਰ ਲੋਕ ਕੋਲ ਲੈਂਡ ਸਮਾਰਟਫੋਨ ਸਨ ਉਸ ਸਮੇਂ ਜਦੋਂ ਨਵੇਂ ਨਵੇਂ ਸਮਾਰਟਫੋਨ ਆਏ ਸਨ ਤਾਂ ਉਸ ਦਾ ਰੇਟ ਬਹੁਤ ਹੀ ਸਸਤਾ ਸੀ ਤਾਂ ਹਰ ਲੋਕਾਂ ਨੇ ਉਸ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ ਅਤੇ ਮੋਬਾਈਲ ਫੋਨ ਮੋਬਾਈਲ ਫੋਨ ਦੀ ਵਰਤੋਂ ਬਹੁਤ ਹੀ ਹੈ ਅਤੇ ਉਸ 'ਤੇ ਲੋਕ ਇੱਕ ਦੂਸਰੇ ਨਾਲ ਗੱਲ ਵੀ ਕਰ ਸਕਦੇ ਹਨ ਜਿਸ ਵਿੱਚ ਉਹ ਉਹਦੇ ਵਿੱਚ ਕੁਝ ਸੋਸ਼ਲ ਮੀਡੀਆ ਐਪਸ ਹਨ ਜਿੱਦਾਂ ਕਿ ਵਟਸਐਪ ਹੋ ਗਿਆ ਇੰਸਟਾਗਰਾਮ ਹੋ ਗਿਆ ਸਨੈਪਚੈਟ ਹੋ ਗਿਆ ਟਵੀਟਰ ਹੋ ਗਿਆ ਅਤੇ ਲੋਕ ਵਟਸਐਪ 'ਤੇ ਇੱਕ ਦੂਸਰੇ ਨੂੰ ਮੈਸੇਜ ਵੀ ਭੇਜ ਸਕਦੇ ਹਨ ਵੀਡੀਓ ਕਾਲਿੰਗ ਵੀ ਕਰ ਸਕਦੇ ਹਨ ਇੱਕ ਦੂਸਰੇ ਨੂੰ ਦੇਖ ਵੀ ਸਕਦੇ ਹਨ ਜੇ ਉਹਨਾਂ ਦਾ ਦਿਲ ਕਰਦਾ ਹੈ ਕਿ ਅਸੀਂ ਇੱਕ ਦੂਸਰੇ ਨੂੰ ਦੇਖੀਏ ਤਾਂ ਉਹ ਵੀਡੀਓ ਕੌਲ 'ਤੇ ਗੱਲ ਕਰ ਸਕਦੇ ਹਨ ਉਹ ਵਟਸਐਪ 'ਤੇ ਸਟੇਟਸ ਵੀ ਪਾਉਂਦੇ ਹਨ ਜਿਹਦੇ ਥਰੂ ਲੋਕਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਕਿੱਥੇ ਹਾਂ ਮਤਲਬ ਜਿਹੜੇ ਲੋਕ ਹੈ ਉਹ ਸਮਾਰਟਫੋਨ ਦੀ ਇੰਨੀ ਵਰਤੋਂ ਕਰਦੇ ਹਨ ਕਿ ਉਹ ਪਲ ਪਲ ਦੀ ਖਬਰ ਦੱਸਦੇ ਰਹਿੰਦੇ ਹਨ ਕਿ ਹਾਂ ਅਸੀਂ ਹੁਣ ਇੱਥੇ ਹਾਂ ਅਸੀਂ ਹੁਣ ਇੱਥੇ ਚੱਲੇ ਹਾਂ ਅਤੇ ਸਮਾਰਟਫੋਨ ਦੀ ਵਰਤੋਂ ਇੰਨੀ ਹੈ ਕਿ ਲੋਕ ਜਿਹੜੇ ਹਨ ਜਿੱਥੇ ਵੀ ਜਾਂਦੇ ਹਨ ਉੱਥੇ ਦੀ ਵੀਡੀਓ ਬਣਾ ਕੇ ਫਟਾਫਟ ਆਪਣੇ ਮੋਬਾਇਲ ਫੋਨਾਂ 'ਤੇ ਸਟੇਟਸ ਪਾ ਦਿੰਦੇ ਹਨ ਅਤੇ ਉੱਥੇ ਜਾ ਕੇ ਤਾਂ ਅਗਰ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ ਤਾਂ ਉਹ ਉੱਥੇ ਦਾ ਮਨੋਰੰਜਨ ਨਹੀਂ ਕਰਦੇ ਬਲਕਿ ਉਹ ਆਪਣੇ ਫੋਨ ਵਿੱਚ ਹੀ ਫੋਟੋਆਂ ਵੀਡੀਓ ਰੀਲਾਂ ਬਣਾਉਂਦੇ ਰਹਿੰਦੇ ਹਨ ਅਤੇ ਉਹ ਸਾਰਾ ਕੁਛ ਆਪਣੇ ਫੋਨ ਦੇ ਵਿੱਚ ਹੀ ਕੈਦ ਕਰਦੇ ਰਹਿੰਦੇ ਹਨ ਅਤੇ ਉੱਥੇ ਦਾ ਮਾਹੌਲ ਨੂੰ ਆਨੰਦ ਨਹੀਂ ਮਾਣ ਪਾਉਂਦੇ ਇਸ ਕਰਕੇ ਜਿਹੜਾ ਮੋ ਮੋਬਾਈਲ ਹੈ ਉਹਦੇ ਵਿੱਚ ਉਹ ਰੀਲਾਂ ਬਣਾ ਕੇ ਆਪਣੀ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ ਰੀਲਾਂ ਰੀਲਾਂ ਪਾ ਕੇ ਉਹ ਵਿਊ ਵਧਾਉਂਦੇ ਹਨ ਅਤੇ ਉਹਨਾਂ ਨੂੰ ਉੱਥੇ ਇੰਸਟਾਗਰਾਮ 'ਤੇ ਲਾਈਕ ਵੀ ਮਿਲਦੇ ਹਨ ਜਿਸ ਕਰਕੇ ਲੋਕ ਜਿਹੜੇ ਹਨ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਅਤੇ ਇੱਕ ਦੂਸਰੇ ਨੂੰ ਦੇਖਦੇ ਰਹਿੰਦੇ ਹਨ ਅਤੇ ਉਹ ਆਪਣੇ ਵਟਸਐਪ 'ਤੇ ਇੱਕ ਦੂਸਰੇ ਨੂੰ ਮੈਸੇਜ ਵੀ ਕਰ ਸਕਦੇ ਹਨ ਇੱਕ ਦੂਸਰੇ ਨੂੰ ਸਟਿਕਰ ਵੀ ਭੇਜ ਸਕਦੇ ਹਨ ਆਡੀਓ ਮੈਸੇਜ ਵੀ ਭੇਜ ਸਕਦੇ ਹਨ ਅਗਰ ਉਹਨਾਂ ਦਾ ਇੱਕ ਦੂਸਰੇ ਦੀ ਆਵਾਜ਼ ਸੁਣਨ ਨੂੰ ਦਿਲ ਕਰੇ ਤਾਂ ਉਹ ਵੀ ਭੇਜ ਸਕਦੇ ਹਨ ਅਤੇ ਉਹ ਆਪਣੇ ਫੋਨ ਵਿੱਚ ਸਾਰਾ ਕੁਝ ਰਿਕਾਰਡ ਕਰ ਸਕਦੇ ਹਨ ਤੇ ਜੇ ਅਗਰ ਸਮਾਰਟਫੋਨ ਦੇ ਇੰਨੇ ਫਾਇਦੇ ਵੀ ਹਨ ਤਾਂ ਉਹਦੇ ਕੁਛ ਨੁਕਸਾਨ ਵੀ ਬਹੁਤ ਹਨ ਲੋਕ ਜਦੋਂ ਕਿਤੇ ਵੀ ਜਾਂਦੇ ਹਨ ਤਾਂ ਉਹ ਫੋਨ ਵਿੱਚ ਹੀ ਲੱਗੇ ਰਹਿੰਦੇ ਹਨ ਉਹ ਆਪਸ ਵਿੱਚ ਗੱਲ ਨਹੀਂ ਕਰਦੇ ਜਿਸ ਕਰਕੇ ਪਰਿਵਾਰ ਦੇ ਰਿਸ਼ਤੇ ਜਿਹੜੇ ਹਨ ਖਰਾਬ ਹੁੰਦੇ ਹਨ ਇਸ ਕਰਕੇ ਜਿਹੜਾ ਫੋਨ ਹੈ ਫਾਇਦੇ ਤਾਂ ਸਾਨੂੰ ਦਿੰਦਾ ਹੀ ਦਿੰਦਾ ਹੈ ਪਰ ਉਹਦੇ ਇਹ ਨੁਕਸਾਨ ਵੀ ਬਹੁਤ ਹੈ ਇਸ ਕਰਕੇ ਜਿਹੜਾ ਸਾਡਾ ਸਮਾਰਟਫੋਨ ਹੈ ਉਹ ਸਾਨੂੰ ਨੁਕਸਾਨ ਵੀ ਪ੍ਰਾਪਤ ਕਰਦਾ ਹੈ ਧੰਨਵਾਦ